ਹਾਂ ਮੈਂ ਆਪਣੇ ਕੋਲਜ ਤੋਂ ਚਿੱਤਰਕਾਰੀ ਸਿੱਖੀ ਹੋਈ ਹੈ ਮੇਰੇ ਜਾਣਕਾਰੀ ਵਿੱਚ ਇੱਕ ਅਜਿਹਾ ਕੋਲਜ ਹੈ ਨਵਾਂਸ਼ਹਿਰ ਵਿੱਚ ਕੇ ਸੀ ਕੋਲਜ ਜਿੱਥੇ ਚਿੱਤਰਕਾਰੀ ਜਾਂ ਕਲਾਕਾਰੀ ਦਾ ਕੋਰਸ ਕਰਾਇਆ ਜਾਂਦਾ ਇੱਕ ਮਲਟੀਮੀਡੀਆ 'ਚ ਇਹ ਕੋਰਸ ਹੈ ਜਿਹਦੇ ਵਿੱਚ ਡਿਜ਼ੀਟਲੀ ਕਲਾਕਾਰੀ ਜੋ ਬੱਚਿਆਂ ਨੂੰ ਸਿਖਾਈ ਜਾਂਦੀ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਅੱਗੇ ਲਈ ਕੈਰੀਅਰ ਹੈ ਕਈ ਬੱਚੇ ਲਾਈਕ ਅ ਕਈ ਬੱਚੇ ਪਸੰਦ ਕਰਦੇ ਹਨ ਅੱਗੇ ਫੋਟੋਗ੍ਰਾਫੀ ਵਿੱਚ ਜਾਣਾ ਜਾਂ ਕਲਾ ਉਹ ਡਿਜ਼ੀਟਲੀ ਕਲਾ ਅੱਜ ਕੱਲ੍ਹ ਤਾਂ ਸਭ ਕੁਝ ਡਿਜ਼ੀਟਲੀ ਹੈ ਤੇ ਇਸ ਲਈ ਬੱਚਿਆਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ